ਹਾਂਜ ਅਸੀਂ ਜੀ ਮੀਡੀਆ ਵਾਲੇ ਬੋਲ ਰਹੇ ਸੀਗੇ ਹਾਂਜੀ ਜੀ ਜੀ ਨਿਊਜ ਤੋਂ ਜੀ ਹਾਂਜੀ ਅਸੀਂ ਨਾ ਬਰਨਾਲੇ 'ਚ ਫਿਲਮ ਸ਼ੂਟ ਕਰਨੀ ਸੀ ਅਤੇ ਤਿਉਹਾਰਾਂ ਦੇ ਰਿਲੇਟਡ ਅਤੇ ਸਾਨੂੰ ਦੱਸੋਗੇ ਵੀ ਇੱਥੇ ਕਿਹੜੇ ਕਿਹੜੇ ਤਿਉਹਾਰ ਮਨਾਏ ਜਾ ਰਹੇ ਨੇ ਜ਼ਿਆਦਾ ਫੇਮਸ ਕਿਹੜੇ ਨੇ ਅਤੇ ਕਿਹੜੀਆਂ ਜਗ੍ਹਾਵਾਂ ਨੇ ਸਾਨੂੰ ਦੱਸਦੋ ਧਾਰਮਿਕ ਹਾਂਜੀ ਧਾਰਮਿਕ ਬਣਾਉਣੀ ਹੈ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ

ਅੱਛਾ ਜੀ ਵੈਸੇ ਜਗ੍ਹਾ ਕਿਹੜੀ ਜ਼ਿਆਦਾ ਧਾਰਮਿਕ ਜੀ ਅੱਛਾ ਜੀ ਅੱਛਾ ਜੀ ਠੀਕ ਆ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਜੀ ਹਾਂਜੀ ਅੱਛਾ ਜੀ ਅਤੇ ਹੋਰ ਬਸ ਇਹੀ ਥਾਵਾਂ ਨੇ ਜੀ ਹੋਰ ਕੋਈ ਠੀਕ ਹੈ ਜੀ ਚਲੋ ਓਕੇ ਜੀ